ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਐਕਚੁਲ 'ਚ ਨਾ ਮੈਂ ਪੁੱਛਣਾ ਸੀਗਾ ਕੱਪੜਿਆਂ ਬਾਰੇ ਜਾਗੋ ਦੇ ਲਈ ਕੱਪੜੇ ਬਣਵਾਉਣੇ ਸੀਗੇ ਮਤਲਬ ਕੀ ਹੁਣ ਲੇਟੇਸਟ ਚੱਲ ਰਿਹਾ ਆਪਣਾ ਓਕੇ ਅਤੇ ਫੁੱਲਕਾਰੀ ਕਿਹੜੇ ਕਿਹੜੇ ਕੱਪੜੇ 'ਚ ਹੈ ਮਤਲਬ ਤੁਸੀਂ ਰੈਡੀ ਕਰ ਰਹੇ ਓ ਓਕੇ ਮਤਲਬ ਤੁਹਾਡਾ ਸਾਰਾ ਜਿਹੜਾ ਕੰਮ ਹੈ ਉਹ ਸਾਰਾ ਹੈਂਡਮੇਡ ਕਰਦੇ ਓ ਤੁਸੀਂ ਠੀਕ ਹੈ ਅਤੇ ਆਪਣਾ ਬਜਟ ਕਿੰਨਾਂ ਕੁ ਪੈਜੇਗਾ ਠੀਕ ਠੀਕ ਹੈ ਠੀਕ ਹੈ ਓਕੇ ਥੈਂਕਯੂ ਥੈਂਕਯੂ ਓਕੇ